ਅਥਲੀਟਾਂ ਨੂੰ ਸਿਖਲਾਈ ਦੇਣ ਲਈ ਸਾਡੇ ਖੇਤਰ ਵਿੱਚ ਕੋਈ ਵਿਸ਼ੇਸ਼ ਕੇਂਦਰ ਨਹੀਂ ਆ ਜਿਵੇਂ ਕਿ ਇੱਕ ਜੇ ਜੇ ਕ੍ਰਿਕਟ ਅਕੈਡਮੀ ਹੈ ਜਾਂ ਤਰਨ ਤਾਰਨ ਡਿਸਟ੍ਰਿਕਟ ਦੇ ਵਿੱਚ ਇੱਕ ਜਿੱਥੇ ਕ੍ਰਿਕਟ ਦੀ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਅਤੇ ਕ੍ਰਿਕਟਰ ਚੰਗੇ ਤਿਆਰ ਕੀਤੇ ਜਾਂਦੇ ਆ ਸਾਡੇ ਲਾਗੇ ਪਿੰਡ ਸੁਰ ਸਿੰਘ ਦੇ ਵਿੱਚ ਕਰਤਾਰ ਸਿੰਘ ਪਹਿਲਵਾਨ ਹੈਗਾ ਜਿਹੜਾ ਕਿ ਬੱਚਿਆਂ ਨੂੰ ਭਲਵਾਨੀ ਦੇ ਦਾਅ ਪੇਚ ਸਿਖਾਉਂਦਾ ਅਤੇ ਚੰਗੇ ਭਲਵਾਨ ਅਥਲੀਟ ਤਿਆਰ ਕਰਦਾ ਵਾ ਜੱਸਾ ਹੈਗਾ ਪੱਟੀ ਤੋਂ ਪਹਿਲਵਾਨ ਉਹ ਵੀ ਬੱਚਿਆਂ ਨੂੰ ਚੰਗੀ ਸਿੱਖਿਆ ਸ਼ਿਕਸ਼ਾ ਦਿੰਦਾ ਵਾ ਟ੍ਰੇਨਿੰਗ ਦੇ ਰਿਹਾ ਵਾ ਅਤੇ ਭਲਵਾਨੀ ਦੇ ਹੀ ਦਾਅ ਪੇਚ ਸਿਖਾਉਂਣ ਡਿਆ ਵਾ ਅਤੇ ਭਲਵਾਨ ਬਣਾਉਂਣ ਡਿਆ ਵਾ ਹੋਰ ਪਿੰਡਾਂ ਦੇ ਬੱਚੇ ਜਿਹੜੇ ਆ ਪਿੰਡ ਦਾ ਜਾਂ ਗਰਾਉਂਡਾਂ ਦੇ ਵਿੱਚ ਜਾਂਦੇ ਆ ਆਪਣੇ ਤੌਰ 'ਤੇ ਫੁੱਟਬਾਲ ਕਬੱਡੀ ਵਾਲੀਬਾਲ ਆਪਣੇ ਮਨਪਸੰਦ ਖੇਡਾਂ ਆਪਣੇ ਤੌਰ 'ਤੇ ਖੇਡਦੇ ਆ ਗੌਰਮੈਂਟ ਵੱਲੋਂ ਸਰਕਾਰਾਂ ਵੱਲੋਂ ਪਿੰਡ ਦੇ ਸਰਪੰਚ ਨੂੰ ਕੁਛ ਗਰਾਂਡ ਆ ਜਿਹਦੇ ਨਾਲ ਉਹ ਪਿੰਡ ਦੇ ਵਿੱਚ ਜਿੰਮ ਖੋਲਦੇ ਆ ਅਤੇ ਜਿੰਮ ਦੇ ਵਿੱਚ ਆਪਣੇ ਤੌਰ 'ਤੇ ਬੱਚੇ ਜਿਹੜੇ ਆ ਉਹ ਆਪਣਾ ਸਿਹਤ ਨੂੰ ਬਿਹਤਰ ਬਣਾਉਣ ਲਈ ਟ੍ਰੇਨਿੰਗ ਲੈਂਦੇ ਆ